ਹਾਂਜੀ ਸਾਡੇ ਬਰਨਾਲਾ ਖੇਤਰ ਦੇ ਵਿੱਚ ਕਲਾ ਅਤੇ ਸੱਭਿਆਚਾਰ ਦੇ ਵਿਕਾਸ ਦੇ ਵਿੱਚ ਸਹਾਇਤਾ ਕਰਨ ਵਾਲੇ ਜਿਹੜੇ ਫੀਡਿੰਗ ਸਰੋਤ ਆ ਨਾ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਗੱਲ ਕਰ ਕਰਦੇ ਹਾਂ ਸਾਡੀਆਂ ਸਰਕਾਰਾਂ ਆ ਗਈਆਂ ਕਾਰਪੋਰੇਟ ਪਰਉਪਕਾਰੀ ਦਾਨੀ ਏਜੰਸੀਆਂ ਆ ਗਈਆਂ ਇਹ ਸਾਰੀਆਂ ਜਿਹੜੀਆਂ ਸਾਡੀਆਂ ਬਹੁਤ ਜ਼ਿਆਦਾ ਮਦਦ ਕਰਦੀਆਂ ਨੇ ਸਾਡੇ ਬਰਨਾਲੇ ਦੇ ਵਿੱਚ ਸਭ ਤੋਂ ਜਿਹੜਾ ਵਧੀਆ ਕੰਮ ਕਰ ਰਹੀਆਂ ਸਥਾਨਕ ਸਰਕਾਰਾਂ ਇੱਥੋਂ ਦੀਆਂ ਵਧੀਆ ਕਰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਕਲਾ ਅਤੇ ਸੱਭਿਆਚਾਰ ਦੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਾਡੀ ਮਦਦ ਕਰਦੇ ਨੇ ਠੀਕ ਹੈ ਉਹ ਸਥਾਨਕ ਕਲਾਕਾਰਾਂ ਅਤੇ ਸੰਸਥਾਵਾਂ ਨੂੰ ਸਾਨੂੰ ਗਰਾਂਟਾਂ ਵੀ ਮਿਲਦੀਆਂ ਨੇ ਉੱਥੋਂ ਸਬਸਿਟੀ ਵੀ ਪ੍ਰਾਪਤ ਹੁੰਦੀ ਹੈਗੀ ਕਿ ਆਪਣੀ ਅਸੀਂ ਕਲਾ ਨੂੰ ਵਧਾ ਲਈਏ ਜਿਵੇਂ ਕਿ ਸਾਡੇ ਇੱਥੇ ਆ ਲੜਕੀਆਂ ਔਰਤਾਂ ਜਿਹੜੀਆਂ ਕਿ ਲੋਣ ਲੈਂਦੀਆਂ ਨੇ ਖੱਡੀ ਵਾਲਾ ਲੋਨ ਉਹਨਾਂ ਨੂੰ ਬੋਲਿਆ ਜਾਂਦਾ ਅਤੇ ਉਹ ਥੋੜ੍ਹੇ ਜਿਹੇ ਪੈਸੇ ਹੀ ਭਰਨੇ ਪੈਂਦੇ ਆ ਉਹਨਾਂ ਨੂੰ ਬਾਕੀ ਉਹਨਾਂ ਨੂੰ ਸਬਸਿਡੀ ਮਿਲ ਜਾਂਦੀ ਹੈ ਤਾਂ ਕਿ ਉਹ ਹੱਥੀਂ ਨਾ ਆਪਣਾ ਖੱਡੀ ਵਗੈਰਾ ਦਾ ਕੰਮ ਕਰਦੀਆਂ ਨੇ ਉਹ ਔਰਤਾਂ ਤਾਂ ਜਿਹੜਾ ਸਾਨੂੰ ਕਿ ਸਾਡੇ ਇਹ ਨਾ ਇੱਥੇ ਨਗਰ ਨਿਗਮ ਦਾ ਬਰਨਾਲੇ ਜਿਹੜੇ ਦਫ਼ਤਰ ਆ ਉੱਥੋਂ ਹੀ ਸਾਨੂੰ ਮਿਲ ਜਾਂਦੇ ਨੇ ਇਹ ਅਤੇ ਉਸ ਤੋਂ ਇਲਾਵਾ ਇਹਦੀਆਂ ਸੈਲਫ ਹੈਲਪ ਗਰੁੱਪ ਬਣਾਉਂਦੀਆਂ ਨੇ ਜਿਹੜੀਆਂ ਲੇਡੀਜ਼ ਉਹ ਵੀ ਸਾਨੂੰ ਜਿਹੜੇ ਸਾਡੇ ਬੈਂਕ ਖੁੱਲ੍ਹੇ ਪਏ ਨੇ ਬਰਨਾਲਾ ਸ਼ਹਿਰ ਦੇ ਵਿੱਚ ਉਹ ਕਹਿ ਦਿੰਦੇ ਵੀ ਤੁਸੀਂ ਗਰੁੱਪ ਬਣਾ ਲਓ ਸੱਠ ਔਰਤਾਂ ਦਾ ਅਤੇ ਕੋਈ ਆਪਣਾ ਲਾਹੇਵੰਦ ਧੰਦਾ ਆਪਣਾਓ ਅਤੇ ਉਸ ਲਾਹੇਵੰਦ ਧੰਦੇ ਤੋਂ ਜਿਹੜੀ ਇਨਕਮ ਹੋਵੇਗੀ ਉਹਦੇ ਨਾਲ ਜਿਹੜਾ ਅਸੀਂ ਤੁਹਾਨੂੰ ਇਹ ਲੋਨ ਦੇਵਾਂਗੇ ਨਾ ਕੰਮ ਕਰਨ ਦੇ ਲਈ ਤੁਹਾਡੀ ਸਹਾਇਤਾ ਕਰਾਂਗੇ ਤਾਂ ਉਹਨੂੰ ਤੁਸੀਂ ਵਾਪਿਸ ਕਰੀ ਜਾਇਓ ਕੁਛ ਤੁਹਾਨੂੰ ਜਿਹੜੀ ਸਬਸਿਡੀ ਮਿਲ ਜੂਗੀ ਇਸ ਤੋਂ ਇਲਾਵਾ ਮੱਝਾਂ ਦੇ ਉੱਪਰ ਸਾਨੂੰ ਲੋਨ ਮਿਲਦਾ ਹੈਗਾ ਇਹ ਸਾਰੀਆਂ ਜਿਹੜੀਆਂ ਕਿ ਨਾ ਸਹੂਲਤਾਂ ਸਾਨੂੰ ਸਾਡੀਆਂ ਸਥਾਨਕ ਸਰਕਾਰਾਂ ਦੇ ਰਹੀਆਂ ਨੇ ਅਤੇ ਜਿਹਦੇ ਲਈ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹੈਗੇ ਬਹੁਤ ਬਹੁਤ ਧੰਨਵਾਦ